ਅਸੀਂ ਜ਼ਿਆਦਾਤਰ ਖਬਰਾਂ ਹਿੰਦੀ ਭਾਸ਼ਾ ਦੇ ਨਿਊਜ਼ ਚੈਨਲ 'ਤੇ ਹੀ ਵੇਖਦੇ ਹਾਂ ਕਿਉਂਕਿ ਇੱਥੇ ਦੇਸ਼ ਵਿਦੇਸ਼ ਦੇ ਲੈਵਲ ਦੀਆਂ ਖਬਰਾਂ ਜ਼ਿਆਦਾ ਵਧੀਆ ਦਿਖਾਈਆਂ ਜਾਂਦੀਆਂ ਹਨ ਇਹ ਚੈਨਲ ਹਨ ਏ ਬੀ ਪੀ ਨਿਊਜ਼ ਐੱਨ ਡੀ ਟੀ ਵੀ ਆਜ ਤੱਕ ਅਗਰ ਮੈਂ ਪੰਜਾਬੀ ਖਬਰਾਂ ਵੇਖਣੀਆਂ ਹਨ ਤਾਂ ਮੈਂ ਆਪਣੇ ਮੂਲ ਭਾਸ਼ਾ ਵਿੱਚ ਜਿਹੜੇ ਚੈਨਲ ਉਪਲੱਬਧ ਹਨ ਉਹਨਾਂ 'ਤੇ ਦੇਖਦੀ ਹਾਂ ਜੋ ਕਿ ਇਸ ਤਰ੍ਹਾਂ ਹਨ ਪੀ ਟੀ ਸੀ ਨਿਊਜ਼ ਜੀ ਪੰਜਾਬ ਹਰਿਆਣਾ ਹਿਮਾਚਲ ਨਿਊਜ਼ ਅਠਾਰ੍ਹਾਂ ਪੰਜਾਬ ਹਰਿਆਣਾ ਹਿਮਾਚਲ ਐੱਮ ਐੱਚ ਵਨ ਨਿਊਜ਼ ਚੜ੍ਹਦੀ ਕਲਾ ਟੀ ਵੀ ਫਾਸਟਵੇ ਨਿਊਜ਼ ਡੀ ਡੀ ਪੰਜਾਬੀ ਕਿਉਂਕਿ ਇਹ ਪੰਜਾਬੀ ਨਿਊਜ਼ ਚੈਨਲ 'ਤੇ ਸਾਡੇ ਖੇਤਰ ਦੇ ਲੈਵਲ ਦੇ ਖਬਰਾਂ ਨੂੰ ਬੜੀ ਡੂੰਘਾਈ ਨਾਲ ਵਿਖਾਇਆ ਜਾਂਦਾ ਹੈ ਅਤੇ ਸਾਨੂੰ ਖਿ ਹਰ ਚੀਜ਼ ਦੀ ਨੌਲੇਜ ਬੜੀ ਆਸਾਨੀ ਨਾਲ ਉਪਲਬਧ ਹੋ ਜਾਂਦੀ ਹੈ